ਮੇਰੇ ਹਿਸਾਬ ਨਾਲ ਸੰਸਾਰ ਅੱਜ ਦੇ ਟਾਇਮ ਵਿੱਚ ਬਹੁਤ ਵਿਕਾਸ ਕਰ ਗਿਆ ਹੈ ਜਿਵੇਂ ਕਿ ਦੇਖਿਆ ਜਾਵੇ ਬੈਂਕ ਦੇ ਵਿੱਚ ਪਹਿਲਾਂ ਜਾ ਕੇ ਆਪਾਂ ਨੂੰ ਲਾਈਨਾਂ ਵਿੱਚ ਖੜ੍ਹਨਾ ਪੈਂਦਾ ਸੀਗਾ ਅੱਜ ਕੱਲ੍ਹ ਆਪਾਂ ਬੈਂਕ ਦਾ ਵੀ ਔਨਲਾਈਨ ਕਰ ਸਕਦੇ ਹਾਂ ਕੁਛ ਵੀ ਕਰਨਾ ਹੋਵੇ ਬੈਂਕ 'ਚ ਅਤੇ ਕੰਪਿਊਟਰ ਲੈਪਟੋਪ ਅਤੇ ਫ਼ੋਨਾਂ 'ਤੇ ਸਾਨੂੰ ਸਟੱਡੀ ਕਰਨ ਦਾ ਵੀ ਸੌਖਾ ਹੋ ਗਿਆ ਜੋ ਵੀ ਕੋਈ ਕੰਮ ਕਰਨਾ ਹੋਵੇ ਐਜੂਕੇਸ਼ਨ ਦਾ ਵੀ ਬਾਕੀ ਕਲਾਸੀਸ ਔਨਲਾਈਨ ਕਲਾਸਾਂ ਵੀ ਆਪਾਂ ਇਹ 'ਤੇ ਲਾ ਸਕਦੇ ਹਾਂ ਜਿਮਸ ਹੁਣ ਜਿੰਮਾਂ ਵੀ ਕਾਫੀ ਖੁੱਲ ਚੁੱਕੀਆਂ ਹਨ ਜਿਮ ਤੋਂ ਆਪਾਂ ਸਿਹਤਮੰਦ ਰਹਿ ਸਕਦੇ ਹਾਂ ਦੇਖਿਆ ਜਾਵੇ ਹਰ ਕੋਈ ਅੱਜ ਕੱਲ੍ਹ ਸਿਹਤਮੰਦ ਆ ਅਤੇ ਬਾਕੀ ਅਸੀਂ ਔਨਲਾਈਨ ਸ਼ੋਪਿੰਗ ਵੀ ਕਰ ਸਕਦੇ ਹੈਗੇ ਹਾਂ ਜੋ ਵੀ ਅਸੀਂ ਦੇਖਦੇ ਹਾਂ ਕੁਛ ਵੀ ਹੋਵੇ ਉਹ ਸਾਨੂੰ ਐਜ਼ ਇੱਟ ਇਜ਼ ਉਹੀ ਚੀਜ਼ ਮਿਲ ਜਾਂਦੀ ਆ ਘੱਟ ਪ੍ਰਾਈਜ਼ 'ਤੇ ਅਤੇ ਵਧੀਆ ਕੁਆਲਿਟੀ ਅਤੇ ਅੱਜ ਕੱਲ੍ਹ ਰੈਸਟੋਰੈਂਟ ਵੀ ਕਾਫੀ ਖੁੱਲ ਚੁੱਕੇ ਨੇ ਜੋ ਆਪਾਂ ਔਨਲਾਈਨ ਔਡਰ ਵੀ ਕਰ ਸਕਦੇ ਹਾਂ ਕੁਛ ਵੀ ਹੋਵੇ ਖਾਣ ਪੀਣ ਦਾ ਅਤੇ ਜਿਵੇਂ ਆਪਾਂ ਨੇ ਕਿਤੇ ਜਾਣਾ ਹੋਵੇ ਆਪਾਂ ਕੈਬ ਡਰਾਈਵਰ ਬੁੱਕ ਕਰ ਸਕਦੇ ਹਾਂ ਕਿਤੇ ਵੀ ਨਾਲੇ ਘੱਟ ਖਰਚੇ 'ਤੇ ਮਿਲ ਜਾਂਦਾ ਹੈ ਬਾਕੀ ਹੋਰ ਐਕਸਪੈਂਸ ਖਰਚੇ ਵੀ ਬਹੁਤ ਘੱਟ ਚੁੱਕੇ ਨੇ ਸਾਡੇ